ਅੱਜ ਕਿੰਨੇ ਦਿਨ ਮਗਰੋਂ ਅਸੀਂ ਸਾਰੇ ਮਿੱਤਰ ਮੇਰੇ ਘਰ ਇਕੱਠੇ ਹੋਏ ਥੋੜ੍ਹੀ ਦੇਰ ਬਾਅਦ ਅਸੀਂ ਸੋਚਿਆ ਕਿਉਂ ਨਾ ਕੁਛ ਖਾਣ ਪੀਣ ਲਈ ਬਾਹਰ ਜਾਇਆ ਜਾਵੇ ਜਿਉਂ ਹੀ ਅਸੀਂ ਘਰੋਂ ਨਿਕਲਣ ਲੱਗੇ ਬਾਹਰ ਤਾਂ ਤੇਜ਼ ਬਾਰਿਸ਼ ਸ਼ੁਰੂ ਹੋ ਗਈ ਫਿਰ ਅਸੀਂ ਸਾਰੇ ਖਾਣ ਪੀਣ ਲਈ ਬਾਹਰ ਤਾਂ ਹੁਣ ਜਾ ਨਹੀਂ ਸਕਦੇ ਸੀ ਅਸੀਂ ਸੋਚਿਆ ਕਿ ਕਿਉਂ ਨਾ ਫੋਨ 'ਤੇ ਔਡਰ ਕੀਤਾ ਜਾਵੇ ਤਰਨ ਤਾਰਨ ਦੇ ਚਾਰ ਖੰਬੇ ਚੌਂਕ ਵਿੱਚ ਸਥਿਤ ਗਗਨ ਜੂਸ ਬਾਰ 'ਤੇ ਅਸੀਂ ਔਡਰ ਕੀਤਾ ਤੀਨ ਪੀਜ਼ਾ ਅਸੀਂ ਮੰਗਵਾਏ ਥੋੜ੍ਹੀ ਦੇਰ ਬਾਅਦ ਹੀ ਲਗਭਗ ਅੱਧੇ ਘੰਟੇ ਤੱਕ ਸਾਡੀ ਬੈੱਲ ਖੜਕੀ ਦਰਵਾਜ਼ੇ ਦੀ ਜਿਉਂ ਹੀ ਬੂਹਾ ਖੋਲ੍ਹਿਆ ਤਾਂ ਵੇਖਿਆ ਡਿਲੀਵਰੀ ਬੋਆਏ ਸਾਡੇ ਔਡਰ ਕੀਤੇ ਹੋਏ ਪੀਜ਼ਾ ਲੈ ਕੇ ਆਇਆ ਅਸੀਂ ਉਸ ਡਿਲੀਵਰੀ ਬੋਆਏ ਦੀ ਹਿੰਮਤ ਦੇ ਅਤੇ ਕੰਮ ਦੇ ਪ੍ਰਤੀ ਉਹਦੀ ਲਗਨ ਦੇ ਵਾਹ ਵਾਹ ਕਰਨ ਲੱਗ ਪਏ ਕਿ ਵਾਹ ਇਸ ਡਿਲੀਵਰੀ ਬੋਆਏ ਨੇ ਮੀਂਹ ਨਾ ਦੇਖਿਆ ਹਨੇਰੀ ਨਹੀਂ ਦੇਖੀ ਆਪਣੇ ਕੰਮ ਦੇ ਲਈ ਇੰਨੀ ਇਹਦੀ ਲਗਨ ਸੱਚੀ ਹੈ ਕਿ ਇਸ ਨੇ ਅਪ ਆਪਣੇ ਕੰਮ ਦੇ ਲਈ ਆਪਣੇ ਕੱਪੜੇ ਤੱਕ ਦੀ ਪਰਵਾਹ ਨਹੀਂ ਕੀਤੀ ਕਿ ਉਹ ਗਿੱਲੇ ਹੋ ਰਹੇ ਆ ਆਪਣੇ ਤਨ ਦੀ ਪਰਵਾਹ ਨਹੀਂ ਕੀਤੀ ਅਤੇ ਉਹ ਆਪਣੇ ਡਿਲੀਵਰੀ ਕਰਨ ਲਈ ਸਾਡੇ ਕੋਲ ਪੀਜ਼ਾ ਲੈ ਕੇ ਆਇਆ ਅਤੇ ਜਦੋਂ ਅਸੀਂ ਪੀਜ਼ਾ ਖਾਧਾ ਉਹਦੇ ਤਾਂ ਸਵਾਦ ਦੇ ਵੀ ਵਾਰੇ ਵਾਰੇ ਜਾਈਏ ਕਿ ਇੰਨਾ ਸਵਾਦ ਪੀਜ਼ਾ ਉਹਨਾਂ ਨੇ ਸਾਨੂੰ ਬਣਾ ਕੇ ਦਿੱਤਾ